ਕੁਝ ਰਵਾਇਤੀ ਪਕਵਾਨਾਂ ਦੇ ਵਿੱਚ ਹੈ ਨਾ ਪਹਿਲਾ ਪਕਵਾਨ ਆਉਂਦਾ ਹੈ ਜਿੱਦਾਂ ਕਿ ਸਭ ਤੋਂ ਮਸ਼ਹੂਰ ਪਕਵਾਨ ਹੈ ਸਾਡੇ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਜਿਹਨੂੰ ਕਿ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਆ ਲੋਕ ਹੈ ਨਾ ਸਰ੍ਹੋਂ ਦਾ ਸਾਗ ਜੋ ਜਿਹੜਾ ਕਿ ਖੇਤਾਂ ਦੇ ਵਿੱਚ ਉਗਾਇਆ ਜਾਂਦਾ ਅਤੇ ਇਨ੍ਹਾਂ ਨੂੰ ਮੰਮੀਆਂ ਘਰਾਂ ਦੇ ਵਿੱਚ ਪਤੀਲੇ ਦੇ ਵਿੱਚ ਪਾ ਕੇ ਸਾਰਾ ਸਾਰਾ ਦਿਨ ਰਿੱਝਾਇਆ ਜਾਂਦਾ ਮੱਕੀ ਦੀ ਰੋਟੀ ਨੂੰ ਹੈ ਨਾ ਮੱਕੀ ਦੇ ਜਿਹੜੀ ਮੱਕੀ ਹੁੰਦੀ ਆ ਮੱਕੀ ਨੂੰ ਪਿਹਾ ਕੇ ਉਹ ਤੋਂ ਮੱਕੀ ਦਾ ਆਟਾ ਤਿਆਰ ਕਰਿਆ ਜਾਂਦਾ ਏਦਾਂ ਮੱਕੀ ਦੀ ਰੋਟੀ ਬਣਾਈ ਜਾਂਦੀ ਹੈ ਸੈਕੰਡ ਨੰਬਰ 'ਤੇ ਹੋ ਗਿਆ ਹੈ ਨਾ ਸਾਡੇ ਆਮ ਤੌਰ 'ਤੇ ਮਸ਼ਹੂਰ ਆ ਹੈ ਨਾ ਚੌਲ਼ ਹੋ ਗਏ ਹੈ ਨਾ ਅਤੇ ਨਮਕੀਨ ਚੌਲ਼ ਬਣਾਏ ਜਾਂਦੇ ਆ ਨਮਕੀਨ ਚੌਲ਼ ਉਦੋਂ ਵੀ ਬਣਾਏ ਜਾਂਦੇ ਆ ਜਦੋਂ ਸਾਡੇ ਬਸੰਤ ਰੁੱਤ ਹੁੰਦੀ ਹੈ ਬਸੰਤ 'ਚ ਜਦੋਂ ਲੋਕ ਪਤੰਗ ਚੜਾਉਂਦੇ ਆ ਹੈ ਨਾ ਉਸ ਦਿਨ ਲੋਕ ਪੀਲੇ ਕੱਪੜੇ ਪਾਉਂਦੇ ਆ ਅਤੇ ਚੌਲ ਬਣਾਉਂਦੇ ਆ ਹੈ ਨਾ ਅਤੇ ਪੀਲੇ ਚੌਲ ਬਣਾ ਕੇ ਖਾਂਦੇ ਆ